ਬਿਜਲੀ ਮਨੁੱਖ ਦੀ ਸਭ ਤੋਂ ਵੱਡੀ ਜ਼ਰੂਰਤ ਬਣ ਗਈ ਹੈ ਬਿਜਲੀ ਤੋਂ ਬਿਨਾਂ ਅਸੀਂ ਕੁਝ ਵੀ ਕੰਮਕਾਰ ਨਹੀਂ ਕਰ ਸਕਦੇ ਬਿਜਲੀ ਜ਼ਿੰਦਗੀ ਦੀ ਮਨੁੱਖ ਦੀ ਜ਼ਿੰਦਗੀ ਦੀ ਅਹਿਮ ਚੀਜ਼ ਹੈ ਬਟ ਪਰ ਇਹ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਭੂਮਿਕਾ ਦੇ ਨਿਭਾਣ ਦੇ ਨਾਲ ਨਾਲ ਬਹੁਤ ਵੱਡਾ ਸਾਡੀ ਜ਼ਿੰਦਗੀ ਲਈ ਖਤਰਾ ਵੀ ਹੈ ਜਿਸ ਨੂੰ ਬਹੁਤ ਦੇਖਭਾਲ ਦੇ ਨਾਲ ਯੂਜ ਕਰਨਾ ਚਾਹੀਦਾ ਹੈ ਬਿਜਲੀ ਦੇ ਨਾਲ ਅਗਰ ਸਾਨੂੰ ਸੁੱਖ ਮਿਲਦਾ ਹੈ ਲਾਈਟਾਂ ਪੱਖੇ ਬਿਜਲੀ ਦੇ ਨਾਲ ਸਾਰਾ ਕੁਝ ਅੱਜ ਦੀ ਵਰਤੋਂ ਦੇ ਵਿੱਚ ਸਭ ਕੁਝ ਬਿਜਲੀ ਨਾਲ ਚੱਲਦਾ ਹੈ ਪਰ ਇਸ ਤੋਂ ਵਿਪਰੀਤ ਸਾਨੂੰ ਇਸ ਤੋਂ ਖਤਰਾ ਵੀ ਬਹੁਤ ਹੈ ਸਾਨੂੰ ਸਭ ਨੂੰ ਇਸ ਨੂੰ ਯੂਜ ਕਰਨ ਦੇ ਲਈ ਬਹੁਤ ਦੇਖ ਰੇਖ ਕਰਨੀ ਚਾਹੀਦੀ ਹੈ ਸਾਨੂੰ ਬਿਜਲੀ ਦਾ ਕੰਮ ਯੂਜ ਕਰਨ ਲਈ ਚੱਪਲਾਂ ਰਬੜ ਦੇ ਚੱਪਲਾਂ ਰਬੜ ਦੇ ਬੂਟਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਸਾਨੂੰ ਇਸ ਤੋਂ ਸੇਫਟੀ ਰੱਖਣੀ ਚਾਹੀਦੀ ਹੈ ਸਾਨੂੰ ਗਿੱਲੇ ਹੱਥਾਂ ਨਾਲ ਜਾਂ ਗਿੱਲੀਆਂ ਚੀਜ਼ਾਂ ਦੇ ਨਾਲ ਜਾਂ ਲੋਹੇ ਦੀ ਵਰਤੋਂ ਇਹਦੇ ਨਾਲ ਨਹੀਂ ਕਰਨੀ ਚਾਹੀਦੀ ਬਿਜਲੀ ਜਿਸ ਤਰ੍ਹਾਂ ਦੀ ਸਾਡੀ ਸਹੂਲਤ ਹੈ ਪਰ ਸਾਨੂੰ ਇਹਦੇ ਤੋਂ ਖਤਰਾ ਵੀ ਬਹੁਤ ਹੈ ਸਾਨੂੰ ਬੱਚਿਆਂ ਨੂੰ ਇਸ ਬਿਜਲੀ ਨਾਲ ਡਾਇਰੈਕਟਰ ਯੂਜ ਕਰਨ ਤੋਂ ਰੋਕਣਾ ਚਾਹੀਦਾ ਹੈ ਬੱਚਿਆਂ ਨੂੰ ਬਿਜਲੀ ਤੋਂ ਬਚਾਉਣਾ ਚਾਹੀਦਾ ਹੈ ਆਪਣੇ ਆਪ ਨੂੰ ਮਨੁੱਖ ਨੂੰ ਬਿਜਲੀ ਤੋਂ ਬਚਾਉਣਾ ਚਾਹੀਦਾ ਹੈ ਬਿਜਲੀ ਤੋਂ ਵਰਤੋਂ ਕਰਨ ਦੇ ਨਾਲ ਨਾਲ ਸਾਨੂੰ ਇਸ ਤੋਂ ਸੇਫਟੀ ਵੀ ਰੱਖਣੀ ਚਾਹੀਦੀ ਹੈ